ਦੌੜਦੇ ਸਮੇਂ ਮੈਂ ਹੈੱਡਫੋਨ ਲਗਾ ਕੇ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ ਹਾਂ ਅਤੇ ਸੋ ਗਾਣੇ ਇਹੇ ਜਿਹੇ ਸੁਣਦਾ ਹਾਂ ਜੋ ਸਰੀਰ ਦੇ ਵਿੱਚ ਜੋਸ਼ ਪੈਦਾ ਕਰ ਦਿੰਦੇ ਹੈ ਅਤੇ ਭੱਜਣ ਦਾ ਜਿੱਥੇ ਮੈਂ ਪੰਜ ਕਿਲੋਮੀਟਰ ਭੱਜਣਾ ਉੱਥੇ ਮੈਂ ਸੱਤ ਅੱਠ ਕਿਲੋਮੀਟਰ ਲਗਾਤਾਰ ਭੱਜ ਲੈਂਦਾ ਅਤੇ ਸਰੀਰ ਨੂੰ ਕਾਫ਼ੀ ਜ਼ਿਆਦਾ ਵਧੀਆ ਰਹਿੰਦਾ ਹੈ